ਹਾਂਜੀ ਜਦ ਇੱਥੇ ਆਂਢ ਗੁਆਂਢ ਦੇ ਹੈਗੇ ਆ ਪੀ ਜੀ ਵਗੈਰਾ ਹੈ ਇੱਥੇ ਜਿੱਥੇ ਸੈਲਾਨੀ ਆਉਂਦੇ ਹਨ ਠਹਿਰਦੇ ਹਾਂ ਸੀ ਉਨ੍ਹਾਂ ਵਾਸਤੇ ਨਾ ਜਿੱਦਾਂ ਕਿ ਰੱਖੇ ਹੋਏ ਆ ਬੈੱਡ ਅੰਦਰ ਬਾਥਰੂਮ ਸੈਪਰੇਟ ਸਾਰਾ ਕੁਝ ਵੀ ਇਹਨਾਂ ਨੂੰ ਕੋਈ ਤਕਲੀਫ਼ ਨਾ ਹੋਵੇ ਇੱਥੇ ਬਹੁਤ ਹੀ ਸਹੂਲਤਾਂ ਦਿੱਤੀ ਜਾਂਦੀ ਹੈ ਪਾਣੀ ਦੀ ਟੈਂਕੀ ਵਗੈਰਾ ਵੀ ਗੀਜਰ ਵਗੈਰਾ ਲਗਾਏ ਹੋਏ ਹਾਂ ਵੀ ਸਰਦੀ ਹੁੰਦੀ ਨਾ ਇੱਥੇ ਜ਼ਿਆਦਾ ਬਰਫ਼ ਪੈ ਜਾਂਦੀ ਹੈ ਫਿਰ ਤਾਂ ਇੱਥੇ ਬਹੁਤ ਉਨ੍ਹਾਂ ਵਾਸਤੇ ਗੱਦੇ ਗੁੱਦੇ ਸਾਰਾ ਕੁਝ ਰਜਾਈਆਂ ਵਗੈਰਾ ਹਰ ਚੀਜ਼ ਦਿੰਦੇ ਹਾਂ ਕਿਚਨ ਵੀ ਸੈਪਰੇਟ ਦਿੰਦੇ ਹੈ ਜਿਹਨਾਂ ਦਾ ਕੋਈ ਮਨ ਕਰੇ ਨਾ ਵੀ ਕੋਈ ਚੀਜ਼ ਖਾਣ ਦਾ ਆਪਣੇ ਲਈ ਫਿਰ ਉਹ ਆਪਣਾ ਬਣਾ ਸਕੇ ਵੈਸੇ ਤਾਂ ਅਸੀਂ ਉਹਨਾਂ ਨੂੰ ਖਾਣਾ ਵੀ ਤਿੰਨ ਟਾਈਮ ਦਾ ਵੀ ਦਿੰਦੇ ਹਾਂ ਬਟ ਉਹਨਾਂ ਦੀ ਆਪਣੀ ਹੁੰਦਾ ਹੈ ਵੀ ਅਸੀਂ ਇਹ ਖਾਣਾ ਹੈ ਚਿਕਨ ਵਗੈਰਾ ਹੋ ਗਿਆ ਕੁਝ ਵੀ ਇਹ ਜਦ ਬਾਹਰ ਘੁੰਮਣ ਆਉਂਦੇ ਹਨ ਤਾਂ ਉਹਨਾਂ ਦੇ ਸ਼ੌਂਕ ਹੁੰਦੇ ਹਾਂ ਅਸੀਂ ਤਾਂ ਸਾਰੀ ਸਹੂਲਤਾਂ ਹੈ ਪੀ ਜੀ ਵਿੱਚ ਤਾਂ ਸਾਰੀ ਸਹੂਲਤਾਂ ਹੈ ਬਹੁਤ ਵਧੀਆ ਬਣਾ ਰੱਖਿਆ ਉਹਨਾਂ ਵਾਸਤੇ ਪਾਰਕ ਵੀ ਹੈ ਬੱਚਿਆਂ ਦੇ ਖੇਡਣ ਦੀ ਜਗ੍ਹਾ ਵੀ ਬਣਾਈ ਹੋਈ ਆ ਹੈ ਨਾਂ ਘੁੰਮਣ ਦੀ ਜਗ੍ਹਾ ਵੀ ਬਹੁਤ ਤਾਂਕਿ ਉਹ ਅਰਾਮ ਨਾਲ਼ ਵੀ ਦਸ ਦਿਨ ਠਹਿਰ ਕੇ ਆਪਣਾ ਬਹੁਤ ਜੋ ਆਪਣਾ ਮਤਲਬ ਘੱਟ ਛੁੱਟੀਆਂ ਬੱਚਿਆਂ ਨਾਲ਼ ਕੱਟ ਸਕੇ ਇੱਥੇ ਬਹੁਤ ਵਧੀਆ ਬਣਾ ਕੇ ਰੱਖਿਆ ਹੋਇਆ ਹੈ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਹੋਵੇ ਪਾਰਕ ਵੀ ਜਾ ਕੇ ਆਪਣੇ ਬੱਚੇ ਝੂਲਾ ਵਗੈਰਾ ਝੂਲ ਸਕਦੇ ਹਾਂ ਹੈ ਨਾ ਇੱਥੇ ਮੰਦਿਰ ਵੀ ਹੈ ਜੇ ਆਪਣਾ ਕੋਈ ਮਲ ਦਸ ਦਿਨ ਕੋਈ ਮਾਤਾ ਆ ਗਈ ਜਿੱਦਾਂ ਕਿ ਬਜ਼ੁਰਗ ਹੈ ਉਨ੍ਹਾਂ ਨਾਲ਼ ਜੀਅ ਨਾ ਲੱਗੇ ਇੱਥੇ ਮੰਦਿਰ ਵੀ ਬਹੁਤ ਵਧੀਆ ਵਧੀਆ ਹਨ ਜਾ ਕੇ ਉੱਥੇ ਬਹਿ ਕੇ ਆਪਣਾ ਕੀਰਤਨ ਭਜਨ ਵਧੀਆ ਨਾਲ਼ ਚੰਗੀ ਤਰ੍ਹਾਂ ਇੱਥੇ ਹੋ ਜਾਂਦੀ ਹੈ ਪੀ ਜੀ ਤਾਂ ਇੱਥੇ ਬਹੁਤ ਬੜੇ ਬੜੇ ਐਂ ਬਟ ਅਸੀਂ ਜਿਹੜਾ ਇੱਥੇ ਹੈ ਨਾ ਸਾਡੇ ਕੋਲ ਇਹ ਬਹੁਤ ਵਧੀਆ ਪੀ ਜੀ ਹੈ ਇਹਦੇ ਵਿੱਚ ਬਹੁਤ ਮਤਲਬ ਤਿੰਨ ਫਲੋਰ ਹੈ ਬਹੁਤ ਵਧੀਆ ਹੈ ਸਾਰੇ ਟੈਂਕੀ ਟੁਕੀ ਲੱਗੀ ਹੋਈ ਹੈ ਬਾਥਰੂਮ ਕਿਚਨ ਸੈਪਰੇਟ ਹਰ ਚੀਜ਼ ਹੈ ਬਹੁਤ ਵਧੀਆ ਹੈ ਇੱਥੇ ਦੀ ਜੇ ਮਨ ਕਰੇ ਤਾਂ ਇੱਥੇ ਆ ਜਾਇਆ ਕਰੋ